ਜੇਕਰ ਹੋਸਪੀਟਲਾਂ ਦੀ ਗੱਲ ਕੀਤੀ ਜਾਏ ਤਾਂ ਸਰਕਾਰੀ ਹੋਸਪੀਟਲਾਂ 'ਤੇ ਪ੍ਰਾਈਵੇਟ ਹੋਸਪੀਟਲਾਂ ਨੂੰ ਅੱਜ ਕੱਲ੍ਹ ਬੜੀ ਸਹੂਲਤ ਦਿੱਤੀ ਜਾ ਰਹੀ ਹੈ ਅੱਜ ਕੱਲ੍ਹ ਗਰੀਬ ਲੋਕਾਂ ਲਈ ਵੀ ਬੜੀ ਸਕੀਮਾਂ ਚੱਲ ਚੁੱਕੀਆਂ ਨੇ ਜਿਸ ਕਰਕੇ ਕਿ ਉਹ ਆਪਣਾ ਇਲਾਜ ਅਰਾਮ ਨਾਲ ਕਰਵਾ ਸਕਦੇ ਹਨ ਅੱਜ ਕੱਲ੍ਹ ਦੀਆਂ ਲਾਈਫ ਇੰਸ਼ੋਰੈਂਸ ਬੜੀਆਂ ਚੱਲ ਚੁੱਕੀਆਂ ਨੇ ਹਰ ਕੋਈ ਹਰ ਤਰ੍ਹਾਂ ਦੇ ਕਾਰਡ ਚੱਲ ਗਏ ਆਯੂਸ਼ਮਾਨ ਕਾਰਡ ਚੱਲ ਚੁੱਕੇ ਹੈ ਜਿਸ ਕਰਕੇ ਕੋਈ ਵੀ ਆਪਣਾ ਇਲਾਜ ਅਰਾਮ ਨਾਲ ਕਰਾ ਸਕਦਾ ਹੈ ਕਿ ਅੱਜ ਪ੍ਰਾਈਵੇਟ ਹੋਸਪੀਟਲਾਂ ਨੂੰ ਸਰਕਾਰੀ ਹੋਸਪੀਟਲਾਂ ਨਾਲ ਪਾਟਨਰਸ਼ਿਪ ਕਰਨੀ ਚਾਹੀਦੀ ਹੈ ਜਿਸ ਕਰਕੇ ਕਿ ਕਿਸੇ ਨੂੰ ਵੀ ਆਉਣ ਆਲੇ ਸਮੇਂ ਵਿੱਚ ਕੋਈ ਵੀ ਤੰਗੀ ਨਾ ਹੋਏ ਗਰੀਬ ਤੋਂ ਗਰੀਬ ਇਨਸਾਨ ਵੀ ਆਪਣਾ ਇਲਾਜ ਅਰਾਮ ਨਾਲ ਕਰਵਾ ਸਕੇ ਅੱਜ ਕੱਲ੍ਹ ਜਿਹੜੇ ਤਾਂ ਵੱਡੇ ਲੋਕ ਹਨ ਉਨ੍ਹਾਂ ਲਈ ਤਾਂ ਬਹੁਤ ਕਾਰਡ ਵਗੈਰਾ ਇੰਸ਼ੋਰੈਂਸ ਵਗੈਰਾ ਚਲ ਚੁੱਕੇ ਹੈ ਤਾਂ ਜੋ ਕਿ ਉਹ ਆਪਣਾ ਇਲਾਜ ਫ੍ਰੀ ਵੀ ਕਰਵਾ ਸਕਦੇ ਹਨ ਪਰ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਗਰੀਬਾਂ ਨੂੰ ਵੀ ਕਿਸੇ ਪ੍ਰਕਾਰ ਦੀ ਤੰਗੀ ਨਾ ਹੋਏ ਉਹ ਵੀ ਆਪਣੇ ਕਾਰਡ ਥਰੂ ਆਪਣਾ ਇਲਾਜ ਕਰਵਾ ਸਕਣ ਉਨ੍ਹਾਂ ਨੂੰ ਵੀ ਦਿਫਾ ਦਵਾਈਆਂ ਔਫਰ ਹੋਣ ਅਰਾਮ ਨਾਲ ਉਹ ਆਪਣੀ ਦਵਾਈਆਂ ਦਾ ਵੀ ਖਰਚਾ ਕਰ ਸਕਣ ਤਾਂ ਜੋ ਕਿ ਉਹ ਵੀ ਠੀਕ ਠਾਕ ਰਹਿਣ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਬਿਮਾਰੀਆਂ ਵੀ ਬਹੁਤ ਚਲ ਗਈਆਂ ਨੇ ਜਿਸ ਕਰਕੇ ਹਰ ਪ੍ਰਕਾਰ ਹਰ ਇਨਸਾਨ ਦੇ ਵਿਚ ਕੋਈ ਨਾ ਕੋਈ ਮੁਸ਼ਕਿਲ ਆ ਰਹੀ ਹੈ ਹਰ ਕਿਸੇ ਦੀ ਬੋਡੀ ਵਿੱਚ ਕੋਈ ਨਾ ਕੋਈ ਤੰਗੀ ਹੈ ਅਸੀਂ ਇਸ ਕਰਕੇ ਕਹਿੰਦੇ ਹਾਂ ਕਿ ਹਰ ਕਿਸੇ ਨੂੰ ਹਰ ਪ੍ਰਕਾਰ ਦੀ ਸਹੂਲਤ ਮਿਲਣੀ ਚਾਹੀਦੀ ਹੈ ਸਰਕਾਰ ਨੂੰ ਸਰਕਾਰ ਨੇ ਕਈ ਪ੍ਰਕਾਰ ਦੀ ਸਹੂਲਤਾਂ ਤਾਂ ਚਾਲੂ ਕਰ ਦਿੱਤੀਆਂ ਹਨ ਪਰ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਗਰੀਬਾਂ ਲਈ ਵੀ ਹਰ ਪ੍ਰਕਾਰ ਦੀ ਸਹੂਲਤ ਕੀਤੀ ਜਾਏ ਤਾਂ ਜੋ ਕਿ ਗਰੀਬਾਂ ਵਿੱਚ ਅਤੇ ਅਮੀਰਾਂ ਵਿੱਚ ਕੋਈ ਫਰਕ ਨਾ ਕੀਤਾ ਜਾਏ ਦੋਨੋਂ ਹਰ ਪ੍ਰਕਾਰ ਦੀ ਆਪਣਾ ਆਪਣਾ ਇਲਾਜ ਕਰਾ ਸਕਣ ਅਤੇ ਠੀਕ ਠਾਕ ਰਹਿ ਸਕਣ